ਪੰਜਾਬ ਇੱਕ ਸਵੈ ਕਮਾਈ ਕਰਨ ਵਾਲਾ ਅਮੀਰ ਰਾਜ ਹੈ ਇੱਕ ਲੋਕਤੰਤਰਿਕ ਪ੍ਰਣਾਲੀ 'ਤੇ ਕੰਮ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਕੁਝ ਅਦਾਰੇ ਪੂਰੀ ਤਰ੍ਹਾਂ ਆਪਣੇ ਨਿਯੰਤਰਣ ਵਿੱਚ ਹਨ ਜਿਵੇਂ ਤਾਂ ਜੋ ਨਿੱਜੀ ਖੇਤਰ ਇਹਨਾਂ ਅਦਾਰਿਆਂ ਵਿੱਚ ਆ ਕੇ ਆਪਣੀਆਂ ਮਨਮਰਜ਼ੀਆਂ ਨਾ ਕਰਨ ਜਿਵੇਂ ਕਿ ਪੰਜਾਬ ਸ਼ਡਿਊਲ ਕਾਸਟ ਐਂਡ ਲੈਂਡ ਡਿਵੈਲਪਮੈਂਟ ਜੋ ਛੋਟੀਆਂ ਜਾਤਾਂ ਦੀ ਉੱਨਤੀ ਲਈ ਕੰਮ ਕਰਦੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜੋ ਪੰਜਾਬ ਦੀ ਬਿਜਲੀ ਸਬੰਧੀ ਸਾਰੇ ਕੰਮਾਂ ਲਈ ਜ਼ਿੰਮੇਵਾਰ ਹੈ ਪੈਪਸੂ ਰੋਡ ਟੋ ਟਰਾਂਸਪੋਰਟ ਜੋ ਕਿ ਪਬਲਿਕ ਟਰਾਂਸਪੋਰਟ ਸਰਵਿਸਿਸ ਪੰਜਾਬ ਜਾਂ ਨਾਲ ਲੱਗਦੇ ਰਾਜਾਂ ਵਿੱਚ ਪਹੁੰਚਾਉਂਦੀ ਹੈ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਜੋ ਕਿ ਪੰਜਾਬ ਦੇ ਅਨਾਜ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਹੈ ਪੰਜਾਬ ਫਾਈਨੈਂਸ ਕਾਰਪੋਰੇਸ਼ਨ ਪੰਜਾਬ ਦੇ ਉਦਯੋਗਾਂ ਨੂੰ ਵਿੱਤੀ ਸਹਾਇਤਾ ਦਿੰਦੀ ਹੈ